ਅਸੀਂ ਸਭ ਤੋਂ ਪਹਿਲਾਂ ਜਦੋਂ ਵੀ ਐਲ ਪੀ ਜੀ ਸਲੰਡਰ ਨੂੰ ਯੂਜ ਕਰਦੇ ਹਾਂ ਉਦੋਂ ਸਭ ਤੋਂ ਪਹਿਲਾਂ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਉਹ ਕਿਸੇ ਸਾਈਡ ਤੋਂ ਲੀਕੇਜ ਜਾਂ ਕਿਸੇ ਵੀ ਤਰ੍ਹਾਂ ਦੀ ਸਮੈਲ ਤਾਂ ਨਹੀਂ ਆ ਰਹੀ ਫਿਰ ਅਸੀਂ ਉਸਨੂੰ ਜੂਜ ਕਰਦੇ ਹਾਂ ਫਿਰ ਜੇਕਰ ਥੋੜ੍ਹੀ ਥੋੜ੍ਹੀ ਸਮੈਲ ਆਉਂਦੀ ਦਿਖੇ ਤਾਂ ਫਿਰ ਸਾਨੂੰ ਘਰ ਦੀਆਂ ਸਭ ਤੋਂ ਪਹਿਲਾਂ ਘਰ ਦੀਆਂ ਸਾਰੀਆਂ ਖਿੜਕੀਆਂ ਔਰ ਬੂਹੇ ਖਟਣ ਸਾਰਿਆਂ ਨੂੰ ਦਰਵਾਜੇ ਖੋਲ੍ਹ ਦੇਣੇ ਚਾਹੀਦੇ ਹਨ ਔਰ ਛੋਟੇ ਬੱਚਿਆਂ ਨੂੰ ਵੀ ਗੈਸ ਤੋਂ ਦੂਰ ਕਰ ਦੇਣਾ ਚਾਹੀਦਾ ਹੈ ਫਿਰ ਸਾਨੂੰ ਗੈਸ ਸਲੰਡਰ ਦੇ ਆਸੇ ਪਾਸੇ ਕੋਈ ਵੀ ਮਾਚਿਸ ਵਗੈਰਾ ਨਹੀਂ ਰੱਖਣੀ ਚਾਹੀਦੀ ਔਰ ਕੋਈ ਵੀ ਪੈਟਰੋਲ ਵਗੈਰਾ ਸਾਨੂੰ ਸਲੰਡਰ ਦੇ ਆਸ ਪਾਸ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਜਦੋਂ ਵੀ ਅਸੀਂ ਸਲੰਡਰ ਨੂੰ ਯੂਜ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਉਹਨੂੰ ਉਹਦੇ ਅੱਛੀ ਤਰ੍ਹਾਂ ਬਟਨ ਚੈੱਕ ਕਰਦੇ ਹਾਂ ਰੈਗੁਲਰ ਚੈੱਕ ਕਰਦੇ ਹਾਂ ਫਿਰ ਉਹਦੀ ਪਾਈਪ ਚੈੱਕ ਕਰਦੇ ਹਾਂ ਫਿਰ ਅਸੀਂ ਉਸਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਫਿਰ ਜਦੋਂ ਵੀ ਅਸੀਂ ਗੈਸ ਸਿਲੰਡਰ ਦੀ ਵਰਤੋਂ ਕਰਕੇ ਹਟ ਜਾਂਦੇ ਹਾਂ ਫਿਰ ਉਸਨੂੰ ਚੰਗੀ ਤਰਾਂ ਸਾਫ਼ ਸੁਥਰਾ ਕਰਕੇ ਔਰ ਰੈਗੂਲੇਟਰ ਦੇਖ ਕੇ ਚੈੱਕ ਕਰਕੇ ਨੀਚੇ ਤੋਂ ਸਟੋਪ ਕਰਕੇ ਚੰਗੀ ਤਰ੍ਹਾਂ ਬੰਦ ਕਰਕੇ ਫਿਰ ਅਸੀਂ ਸਾਈਡ ਹੋ ਜਾਂਦੇ ਹਾਂ ਜਦੋਂ ਵੀ ਅਸੀਂ ਖਾਣਾ ਬਣਾਉਦੇ ਹਾਂ ਅਸੀਂ ਗੈਸ ਦੇ ਉੱਪਰ ਡਾਇਰੈਕਟ ਰੋਟੀ ਵੀ ਨਹੀਂ ਸੇਕਦੇ ਅਸੀਂ ਰੋਟੀ ਵੀ ਹੀ ਤਵੇ ਉਪਰ ਸੇਕਦੇ ਹਾਂ ਕਿਉਂਕਿ ਗੈਸ ਤੋਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਡਰ ਹੁੰਦਾ ਹੈ ਜੀ ਇਸ ਕਰਕੇ ਅਸੀਂ ਗੈਸ ਐੱਲ ਪੀ ਜੀ ਵਰਤੋਂ ਬਹੁਤ ਜ਼ਿਆਦਾ ਘੱਟ ਕਰਦੇ ਹਾਂ ਅਸੀਂ ਜ਼ਿਆਦਾ ਚੁੱਲ੍ਹੇ ਦੀ ਵਰਤੋਂ ਕਰਦੇ ਹਾਂ